ਹਾਂਜੀ ਪਿੰਡਾਂ ਦੇ ਵਿੱਚ ਆਟੋ ਦਾ ਪ੍ਰਬੰਧ ਹੋਣਾ ਚਾਹੀਦਾ ਇਹ ਨਹੀਂ ਹੈਗਾ ਆਵਾਜਾਈ ਦੇ ਵੈਸੇ ਸਾਧਨ ਚਾਹੇ ਸ ਬਸ ਸਰਵਿਸ ਕਿੰਨੀ ਵੀ ਹੈ ਬਟ ਆਟੋ ਕੈਬ ਵਗੈਰਾ ਹੋਣੀਆਂ ਚਾਹੀਦੀਆਂ ਨੇ ਕੁਛ ਕੁ ਪਿੰਡਾਂ ਨੂੰ ਅਜੇ ਵੀ ਬੱਸਾਂ ਨਹੀਂ ਜਾਂਦੀਆਂ ਜਿਵੇਂ ਫਫੜਿਆਂ ਤੋਂ ਫਰਮਾਹੀ ਨੂੰ ਹਜੇ ਤੱਕ ਕੋਈ ਬਸ ਨਹੀਂ ਜਾਂਦੀ ਭਿੱਖੀ ਨੂੰ ਕੋਈ ਬਸ ਨਹੀਂ ਜਾਂਦੀ ਇੱਧਰ ਨੂੰ ਬੱਸਾਂ ਦੀ ਸਰਵਿਸ ਚਲਾਉਣੀ ਚਾਹੀਦੀ ਹੈ